ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਸਰ ਦੱਸੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਹੈ ਦੱਸੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਦੇ ਸਕਦੇ ਹਾਂ ਜੀ ਸਰ ਪੰਜਾਬ ਵਿੱਚ ਸਰ ਪੰਜਾਬ ਵਿੱਚ ਘੁੰਮਣ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਡਾ ਸ਼੍ਰੀ ਹਰਿਮੰਦਰ ਸਾਹਿਬ ਆ ਮੁੱਖ ਮੇਨ ਜਿੱਥੇ ਜਿੱਥੇ ਬਹੁਤ ਦੂਰ ਦੂਰ ਤੋਂ ਆ ਕੇ ਦੁਨੀਆਂ ਨਤਮਸਤਕ ਹੁੰਦੀ ਹੈ ਠੀਕ ਹੈ ਜੀ ਇਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਸਾਇਆ ਵਸਾਈ ਹੋਈ ਨਗਰੀ ਆ ਅੰਮ੍ਰਿਤਸਰ ਠੀਕ ਆ ਉਸਦੇ ਨਾਲ ਹੀ ਜਲਿਆਂਵਾਲਾ ਜਲਿਆਂਵਾਲਾ ਬਾਗ ਆ ਠੀਕ ਆ ਔਰ ਉਸ ਤੋਂ ਬਾਅਦ ਬਾਗਾ ਬਾਡਰ ਜਾ ਸਕਦੇ ਹਾਂ ਅਸੀਂ ਘੁੰਮਣ ਵਾਸਤੇ ਉਸ ਤੋਂ ਬਾਅਦ ਅਸੀਂ ਅਨੰਦਪੁਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਆ ਸਕਦੇ ਹਾਂ ਜੀ ਉੱਥੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ ਜੀ ਫਿਰ ਉਸ ਤੋਂ ਬਾਅਦ ਅਸੀਂ ਫਤਿਹਗੜ੍ਹ ਸਾਹਿਬ ਜਾ ਸਕਦੇ ਹਾਂ ਜੀ ਉੱਥੇ ਛੋਟੇ ਸਾਹਿਬਜ਼ਾਦਿਆਂ ਦਾ ਮਤਲਬ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਉੱਤੋਂ ਨਾਲ ਹੀ ਉਹਨਾਂ ਨੂੰ ਰਾਤ ਭਰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀਗਾ ਠੀਕ ਆ ਠੀਕ ਆ ਜੀ ਤੁਸੀਂ ਮੈਨੂੰ ਕੋਲ ਕਰ ਲੈਣਾ ਅਗਰ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਤੁਹਾਨੂੰ ਖੁਦ ਮਤਲਬ ਨਾਲ ਜਾ ਕੇ ਘੁੰਮਾ ਦਾਂਗੀ ਅਗਰ ਨਹੀਂ ਹੋਇਆ ਤਾਂ ਤੁਸੀਂ ਐਨੀ ਟਾਈਮ ਕਿਸੇ ਵੀ ਟਾਈਮ ਮੈਨੂੰ ਫੋਨ ਕਰ ਸਕਦੇ ਹੋ ਜੀ ਠੀਕ ਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ